ਨਿਊਜ਼ ਮੀਡੀਆ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਨਾਲ ਸੰਬੰਧਿਤ ਮੁੱਦਿਆਂ 'ਤੇ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਪ੍ਰਸਾਰਿਤ ਕਰਦਾ ਰਹਿੰਦਾ ਹੈ ਸਿੱਖਿਆ ਦੇ ਨਾਲ ਸੰਬੰਧਿਤ ਮੀਡੀਆ ਚੈਨਲ ਜਿਹੜੇ ਹੈਗੇ ਆ ਉਹ ਕਿੱਥੇ ਕਿੱਥੇ ਕਿਹੜੇ ਕਿਹੜੇ ਕੋਰਸ ਕਿਹੜੀਆਂ ਕਿਹੜੀਆਂ ਯੂਨੀਵਰਸਿਟੀਆਂ ਦੇ ਦੁਆਰਾ ਕਿੰਨੇ ਕਿੰਨੇ ਪਰੋ ਕਿੰਨੇ ਕਿੰਨੇ ਸਾਲਾਂ ਦੇ ਪ੍ਰੋਗਰਾਮ ਜਾਂ ਕਿਸ ਸ ਕਿ ਕਿਸ ਤਰ੍ਹਾਂ ਦੀ ਫੀਸ ਸਟਰਕਚਰ ਦੇ ਨਾਲ ਪ੍ਰੋਵਾਈਡ ਹੁੰਦੇ ਨੇ ਉਹਦੀ ਜਾਣਕਾਰੀ ਲੋਕਾਂ ਨੂੰ ਦਿੰਦਾ ਰਹਿੰਦਾ ਹੈ ਇਸ ਤੋਂ ਇਲਾਵਾ ਹਰ ਤਰ੍ਹਾਂ ਦੀ ਐਡਵਟਾਈਜ਼ਮੈਂਟ ਜਾਂ ਇਸ਼ਤਿਹਾਰ ਜਿਹੜੇ ਹੈਗੇ ਨੇ ਟੈਲੀਵਿਜ਼ਨ ਜਾਂ ਅਖਬਾਰਾਂ ਵਿੱਚ ਜਾਂ ਇੰਟਰਨੈੱਟ ਦੇ ਉੱਤੇ ਵੀ ਦਿੱਤੇ ਜਾਂਦੇ ਨੇ ਇਸ ਤੋਂ ਇਲਾਵਾ ਸਿਹਤ ਨਾਲ ਸੰਬੰਧਿਤ ਜਿਹੜੇ ਪ੍ਰੋਗਰਾਮਸ ਹੈਗੇ ਨੇ ਉਹ ਟੈਲੀਵਿਜ਼ਨ ਦੇ ਉੱਤੇ ਅਤੇ ਜਿਹੜੀਆਂ ਪ੍ਰਸਾਰਿਤ ਕੀਤੇ ਜਾਂਦੇ ਨੇ ਜਿਹਦੇ ਵਿੱਚ ਲੋਕਾਂ ਨੂੰ ਵੱਖ ਵੱਖ ਤਰ੍ਹਾਂ ਦੇ ਸਿੱਖਿਆ ਮਾਹਿਰਾਂ ਦੁਆਰਾ ਦਿੱਤੀਆਂ ਸਲਾਹਾਵਾਂ ਦੇ ਦੁਆਰਾ ਪ੍ਰਸਾਰਿਤ ਕੀਤਾ ਜਾਂਦਾ ਹੈ